ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਥ੍ਰੀ ਈਅਰਸ ਤੋਂ ਬਾਅਦ ਗੇਮਜ਼ ਆ ਜਾਂਦੀਆਂ ਨੇ ਬੱਚੇ ਨੂੰ ਜਿਵੇਂ ਐਕਟੀਵਿਟੀਜ਼ ਦੇਣੀਆਂ ਏ ਨਾ ਬੱਚਾ ਐਕਟਿਵ ਰਵੇ ਸਾਰਾ ਦਿਨ ਉਹ ਪਲੇਅ ਕਰਨਾ ਸਿੱਖੇ ਥ੍ਰੀ ਈਅਰਸ ਤੋਂ ਬਾਅਦ ਗੇਮਜ਼ ਸਟਾਰਟ ਹੋ ਜਾਂਦੀਆਂ ਬੱਚਾ ਕਿਸੇ ਵੀ ਈਅਰ ਤੱਕ ਕਰ ਸਕਦਾ ਦੋ ਤੋਂ ਬਾਅਦ ਹੈ ਨਾ ਕੰਟੀਨਿਊ ਬੜੀਆ ਗੇਮਜ਼ ਨੇ ਜਿਵੇਂ ਸਵੀਮਿੰਗ ਹੋਗੀ ਕ੍ਰਿਕਟ ਹੋਗੀ ਬੈਡਮਿੰਟਨ ਹੋਗਿਆ ਬਾਸਕਟਵਾਲ ਵਾਲੀਬਾਲ ਇੱਦਾਂ ਦੀਆਂ ਲਾਈਕ ਐਕਸਟਰਾ ਐਕਸਟਰਾ ਗੇਮਜ਼ ਜਿੰਨੀਆਂ ਵੀ ਆਪਣੀਆਂ ਗੇਮਜ਼ ਹੁੰਦੀਆਂ ਨੇ ਅਤੇ ਸਾਰੀਆਂ ਈ ਗੇਮਜ਼ ਆਂ ਅਤੇ ਅਸੀਂ ਪ੍ਰੋਵਾਈਡ ਕਰਦੇ ਹਾਂ

ਅਤੇ ਬੱਚੇ ਦੀ ਵੈਸੇ ਏਜ਼ ਕਿਆ ਹੈ ਤੁਹਾਡੇ ਦੀ ਸਰ ਬਟ ਸਿਕਸ ਈਅਰਸ ਅਤੇ ਓਹਨੂੰ ਬੜੇ ਹੀ ਕੋਪਰੇਟ ਤਰੀਕੇ ਨਾਲ ਉਹਨੂੰ ਇੱਕ ਉਹ ਦਿਆ ਜਾਏਗਾ ਕੋਡੀਨੇਟਰ ਸਰ ਅਤੇ ਜਿਹੜੇ ਓਹਨੂੰ ਨਾਲ ਹੋ ਕੇ ਨਾਲ ਬਿਠਾ ਕੇ ਸਭ ਕੁਛ ਸਿਖਾਣਗੇ ਡੋਂਟ ਟੇਕ ਟੈਨਸ਼ਨ ਅਬਾਉਟ ਐਨੀਥਿੰਗ ਹੈ ਨਾ ਅਤੇ ਬਾਕੀ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ ਦਾ ਖਾਸ ਧਿਆਨ ਆ ਬੱਚਾ ਏ ਉਹ ਓਹਦੇ ਲਈ ਜ਼ਿਆਦਾ ਸਾਨੂੰ ਥੋੜ੍ਹਾ ਓਹਨੂੰ ਇਪੋਟੈਂਸ ਦੇਣੀ ਪਵੇਗੀ ਫੀਸ ਸਟਰੱਕਚਰ ਉਹ ਵਰਕ 'ਤੇ ਡਿਪੈਂਡ ਕਰਦਾ ਤੁਸੀਂ ਬੱਚੇ ਦੀ ਸਵੀਮਿੰਗ ਕਹਿ ਰਹੇ ਓ ਓਹਦੀ ਏਜ਼ ਹੈ ਸਿਕਸ ਸੈਵਨ ਈਅਰ ਉਹਦੀ ਫੀਸ ਹੋਏਗੀ ਮੈਕਸੀਮਮ ਟੂ ਮੈਕਸੀਮਮ ਵਨ ਮਨਥ ਫਾਈਵ ਥਾਊਜ਼ੈਂਟ ਹੋਏਗਾ ਫਾਈਵ ਥਾਊਜ਼ੈਟ ਪਰ ਮਨਥ ਹਾਂਜੀ ਹਾਂਜੀ ਹਾਂਜੀ ਟਾਈਮਿੰਗ ਆਪਣੇ ਮੋਰਨਿੰਗ ਟੈਮ ਤੋਂ ਸਟਾਰਟ ਹੋ ਜਾਂਦਾ ਹੈ ਈਵਨਿੰਗ ਦੇ ਅੱਠ ਵਜੇ ਤੱਕ ਚੱਲਦਾ ਹੈ ਓਹਦੇ ਵਿੱਚ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ ਹਾਂਜੀ ਹਾਂਜੀ ਕੋਈ ਚੱਕਰ ਨੀ ਓਕੇ ਥੈਂਕ ਯੂ ਸਰ